ਦੋ ਅਕਤੂਬਰ ਉੱਨੀ ਸੌ ਉਣਹੱਤਰ ਦਸ ਜਨਵਰੀ ਉੱਨੀ ਸੌ ਉਣਾਨਵੇਂ ਪੱਚੀ ਫਰਵਰੀ ਉੱਨੀ ਸੌ ਉਨਾਹਟ ਬਾਈ ਦਸੰਬਰ ਉੱਨੀ ਸੌ ਉਣਾਸੀ ਅਠਾਰ੍ਹਾਂ ਅਗਸਤ ਉੱਨੀ ਸੌ ਨੜਿਨਵੇਂ